ਸੰਗੀਤ ਵਿੱਚ ਸਾਹ ਨੂੰ ਨਿਯੰਤਰਨ ਕਰਨਾ ਅਤੇ ਸਥਿਰ ਰੱਖਣਾ ਬਹੁਤ ਜ਼ਰੂਰੀ ਹੈ ਅਤੇ ਮਿਊਜ਼ਿਕ ਦੇ ਸਾਰੇ ਸਟੂਡੈਂਟਸ ਨੂੰ ਸਾਹ ਨੂੰ ਨਿਯੰਤਰਕ ਨਿਯੰਤਰਨ ਕਰਨ ਲਈ ਬਹੁਤ ਬਹੁਤ ਅਲੱਗ ਅਲੱਗ ਐਕਸਰਸਾਈਜ਼ ਦੱਸੀਆਂ ਜਾਂਦੀਆਂ ਨੇ ਸਭ ਤੋਂ ਪਹਿਲੀ ਔਰ ਬੇਸਿਕ ਔਰ ਸਭ ਤੋਂ ਕਾਮਯਾਬ ਐਕਸਰਸਾਈਜ਼ ਹੈਗੀ ਹੈ ਸੰਗੀਤ ਦੇ ਸੱਤ ਸੁਰ ਹੁੰਦੇ ਹਨ ਸੰਗੀਤ ਦਾ ਸਭ ਤੋਂ ਪਹਿਲਾ ਸਵਰ ਸਾ ਹੁੰਦਾ ਹੈ ਸੋ ਸਵੇਰੇ ਉੱਠ ਕੇ ਫ ਸਵੇਰੇ ਉੱਠ ਕੇ ਫਰੈਸ਼ ਗਲਾ ਜਦੋਂ ਆਪਣਾ ਹੁੰਦਾ ਉਦੋਂ ਆਪਾਂ ਸਿਰਫ਼ ਸਾ ਬੋਲਣੈ ਫੋਰ ਅਗਜ਼ਾਮਪਲ ਸੋ ਮਿਊਜ਼ਿਕ ਦੇ ਸਟੂਰੈਂਟਸ ਸਟੂਡੈਂਟਸ ਨੂੰ ਇਸ ਤਰ੍ਹਾਂ ਸਾ ਨੂੰ ਨਿਯੰਤਰਨ ਅਤੇ ਸਥਿਰ ਕਰਨ ਦਈ ਕਰਨ ਲਈ ਵੱਖ ਵੱਖ ਐਕਸਰਸਾਈਜ਼ਾਂ ਕਰਵਾਈਆਂ ਜਾਂਦੀਆਂ ਨੇ